ਮਛੇਰਿਆਂ ਦੀ ਮੇਨ ਜਾਤਾਂ ਸਮੁੰਦਰ ਦੇ ਨੇੜੇ ਹੀ ਰਹਿੰਦੀਆਂ ਹਨ ਇਹਨਾਂ ਦਾ ਮੇਨ ਤਿਉਹਾਰ ਕ੍ਰਿਸਮਿਸ ਹੈ ਸਾਰੇ ਮਛੇਰੇ ਉਸ ਸਮੇਂ ਇਕੱਠੇ ਹੋ ਕੇ ਬਹੁਤ ਹੀ ਉਤਸਾਹ ਨਾਲ ਕ੍ਰਿਸਮਿਸ ਦਾ ਤਿਉਹਾਰ ਮਨਾਉਂਦੇ ਹਨ ਅਤੇ ਨੱਚਣ ਗਾਉਣ ਵਾਲਾ ਪ੍ਰੋਗਰਾਮ ਕਰਦੇ ਹਨ